ਮੇਰੀ ਜ਼ਿੰਦਗੀ ਦਾ ਹੁਣ ਤੱਕ ਦਾ ਸਭ ਤੋਂ ਮਹੱਤਵਪੂਰਨ ਫੈਸਲਾ ਉਹ ਸੀ ਜਦੋਂ ਮੈਂ ਟਵੈਲਫਥ ਤੋਂ ਬਾਅਦ ਆਪਣਾ ਕਰੀਅਰ ਡਿਸਾਈਡ ਕਰਨਾ ਸੀਗਾ ਮੈਂ ਦੋ ਹਜ਼ਾਰ ਇੱਕੀ ਵਿੱਚ ਆਪਣੀ ਟਵੈਲਫਥ ਪਾਸ ਕੀਤੀ ਹੈ ਅਤੇ ਉਸ ਸਾਲ ਦੇ ਵਿੱਚ ਸੀ ਬੀ ਐਸ ਈ ਦੇ ਟਵੈਲਫਥ ਦੇ ਬੋਰਡ ਐਗਜ਼ਾਮ ਨਹੀਂ ਹੋਏ ਸ ਅ ਸੀ ਕੋਵਿਡ ਕਰਕੇ ਜਿਸ ਕਰਕੇ ਮੈਂ ਹੋਰ ਵੀ ਜ਼ਿਆਦਾ ਟੈਂਸ਼ਨ ਦੇ ਵਿੱਚ ਸੀ ਕਿ ਮੈਨੂੰ ਅੱਗੇ ਕਿਸ ਫੀਲਡ ਦੇ ਵਿੱਚ ਜਾਣਾ ਚਾਹੀਦਾ ਹੈ ਅਤੇ ਕਿਸ ਫੀਲਡ ਦੇ ਵਿੱਚ ਨਹੀਂ ਅੱਗੇ ਜੋ ਡਿਗਰੀ ਲਈ ਐਂਟਰੈਂਸ ਇਗਜ਼ਾਮ ਹੁੰਦੇ ਹਨ ਉਹਦਾ ਵੀ ਕੁਛ ਕਨਫਰਮ ਨਹੀਂ ਸੀ ਕਿ ਉਹ ਐਂਟਰੈਂਸ ਹੋਣੇ ਨੇ ਕਿ ਨਹੀਂ ਹੋਣੇ ਅਤੇ ਅਸੀਂ ਇਸ ਦਿੱਕਤ ਦੇ ਵਿੱਚ ਸੀ ਕਿ ਐਂਟਰੈਂਸ ਦੀ ਤਿਆਰੀ ਕਰੀਏ ਨਾ ਕਰੀਏ ਜਾਂ ਫਿਰ ਅਗਰ ਕਰਨੀ ਹੈ ਤਾਂ ਕਿਸ ਐਂਟਰੈਂਸ ਦੀ ਤਿਆਰੀ ਕਰੀਏ ਅਤੇ ਐਨੀਆਂ ਸਾਰੀਆਂ ਅਲੱਗ ਅਲੱਗ ਔਪਸ਼ਨਸ ਹੋਣ ਕਰਕੇ ਮੈਂ ਬਹੁਤ ਹੀ ਜ਼ਿਆਦਾ ਕਨਫਿਊਜ ਸੀ ਕਿ ਮੈਨੂੰ ਆਪਣਾ ਕਰੀਅਰ ਕਿਸ ਫੀਲਡ ਵਿੱਚ ਬਣਾਉਣਾ ਚਾਹੀਦਾ ਹੈ ਇਸ ਮੈਂ ਜਦੋਂ ਵੀ ਕਿਸੇ ਕਨਫਿਊਜ਼ਨ ਦੇ ਵਿੱਚ ਹੁੰਦੀ ਹਾਂ ਤਾਂ ਮੈਂ ਸਭ ਤੋਂ ਪਹਿਲੀ ਸਲਾਹ ਆਪਣੇ ਮਾਤਾ ਪਿਤਾ ਤੋਂ ਲੈਂਦੀ ਹਾਂ ਆਪਣੇ ਕਰੀਅਰ ਡਿਸਾਈਡ ਕਰਨ ਬਾਰੇ ਮੈਂ ਸਲਾਹ ਆਪਣੇ ਪਿਤਾ ਜੀ ਤੋਂ ਲਈ ਅਤੇ ਉਹ ਵੀ ਵਕੀਲ ਨੇ ਜਿਸ ਕਰਕੇ ਮੇਰਾ ਇੰਟਰਸਟ ਜੋ ਹੈ ਉਹ ਲੋਅ ਦੇ ਵਿੱਚ ਸ਼ੁਰੂ ਤੋਂ ਹੀ ਸੀਗਾ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਕਿ ਤੈਨੂੰ ਵ ਲੌਜ ਦੇ ਵਿੱਚ ਜਾਣਾ ਚਾਹੀਦਾ ਹੈ ਅਤੇ ਫਿਰ ਮੈਂ ਇਸ ਬਾਰੇ ਰਿਸਰਚ ਕੀਤੀ ਅਤੇ ਆਪਣੇ ਹੀ ਡਿਸਟਰਿਕਟ ਦੇ ਵਿੱਚ ਰਿਆਤ ਕੋਲੇਜ ਔਫ ਲੋਅ ਦੇ ਵਿੱਚ ਐਡਮਿਸ਼ਨਸ ਦੇ ਬਾਰੇ ਪਤਾ ਕੀਤਾ ਦੋ ਹਜ਼ਾਰ ਇੱਕੀ ਸੈਪਤੈਂਬਰ ਦੇ ਵਿੱਚ ਮੈਂ ਇਸ ਕੋਲੇਜ ਦੇ ਵਿੱਚ ਐਡਮਿਸ਼ਨ ਲੈ ਲਈ ਸੀ ਅਤੇ ਉਸ ਤੋਂ ਬਾਅਦ ਹੁਣ ਮੈਨੂੰ ਤਕਰੀਬਨ ਤਿੰਨ ਸਾਲ ਹੋ ਗਏ ਨੇ ਇੱਥੇ ਪੜ੍ਹਾਈ ਕਰਦੀ ਨੂੰ ਅਤੇ ਹੁਣ ਮੈਂ ਸੋਚਦੀ ਹਾਂ ਕਿ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਫੈਸਲਾ ਬਿਲਕੁਲ ਸਹੀ ਲਿਆ ਹੈ ਕਿਉਂਕਿ ਇਹਨਾਂ ਤਿੰਨ ਸਾਲਾਂ ਵਿੱਚ ਮੈਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਹੈ ਅਤੇ ਕਰੀਅਰ ਬਾਰੇ ਵੀ ਬਹੁਤ ਕੁਛ ਪਤਾ ਲੱਗਿਆ ਹੈ ਅਤੇ ਮੈਂ ਆਪਣੇ ਇਸ ਫੈਸਲੇ ਤੋਂ ਬਹੁਤ ਹੀ ਖੁਸ਼ ਹਾਂ